ਸਤਿ ਸ਼੍ਰੀ ਅਕਾਲ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੇ ਮੌਕੇ ਲਈ ਕਈ ਤਰੀਕਿਆਂ ਨਾਲ ਤਿਆਰ ਕਰਦੀ ਹੈ ਇਸ ਪ੍ਰਣਾਲੀ ਦਾ ਉਦੇਸ਼ ਨਾ ਸਿਰਫ ਅਕਾਦਮਿਕ ਜਾਣਕਾਰੀ ਪ੍ਰਦਾਨ ਕਰਨਾ ਹੈ ਬਲਕਿ ਵਿਦਿਆਰਥੀਆਂ ਨੂੰ ਜੀਵਨ ਦੀ ਚੁਣੌਤੀਆਂ ਲਈ ਵੀ ਤਿਆਰ ਕਰਨਾ ਹੈ ਇਹ ਕੁਝ ਮੁ ਮੁੱਖ ਤਰੀਕੇ ਹਨ ਜਿਨ੍ਹਾਂ ਨਾਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਤਿਆਰ ਕਰਦੀ ਹੈ ਪਹਿਲਾ ਜਿੱਦਾਂ ਕਿ ਅਕਾਦਮਿਕ ਉੱਚਤਾ ਪੰਜਾਬ ਦੇ ਪੰਜਾਬ ਦੇ ਸਕੂਲ ਅਤੇ ਕੋਲਜ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਦੇ ਹਨ ਜੋ ਵਿਦਿਆਰਥੀ ਨੂੰ ਉਹਨਾਂ ਦੀ ਰੁਚੀ ਅਨੁਸਾਰ ਵੀ ਸਹੀ ਸਹੀ ਖੇਤਰਾਂ ਵਿੱਚ ਮੁਹਾਰਤ ਹਾਸਿਲ ਕਰਨ ਲਈ ਤਿਆਰ ਕਰਦੇ ਹਨ ਦੂਸਰਾ ਬਜਾਬ ਪੰਜਾਬ ਸਹਾਇਕ ਸਿੱਖਿਆ ਅਤੇ ਟ੍ਰੇਨਿੰਗ ਪੰਜਾਬ ਵਿੱਚ ਪੰਜਾਬ ਸਾਹਿਕ ਸਿੱਖਿਆ ਦੇ ਕਈ ਮੌਕੇ ਹਨ ਜੋ ਵਿਦਿਆਰਥੀਆਂ ਨੂੰ ਕਾਮਯਾਬ ਕਰੀਅਰ ਲਈ ਵਿਸ਼ੇਸ਼ ਸਕੋਲਿਜ ਅਤੇ ਜਾਣਕਾਰੀ ਪ੍ਰਦਾਨ ਕਰਦੇ ਹਨ ਤੀਸਰਾ ਪ੍ਰੈਕਟੀਕਲ ਅਤੇ ਹੱਥ 'ਤੇ ਸਿੱਖਿਆ ਪੰਜਾਬ ਦੇ ਸਿਖਸ਼ਾ ਸੰਸਥਾਨ ਥਓਟੀਕਲ ਜਾਣਕਾਰੀ ਦੇ ਨਾਲ ਨਾਲ ਪ੍ਰੈਕਟੀਕਲ ਅਨੁਸਾਰ ਦੇਣ 'ਤੇ ਵੀ ਜ਼ੋਰ ਦਿੰਦੇ ਹਨ ਲੈਬਰੇਟਰੀਸ ਵਕ ਵਕਸ਼ਾਪਸ ਅਤੇ ਇਡਸ ਇੰਡਿਸਟੀਰੀਅਲ ਰਾਹੀਂ ਵਿਦਿਆਰਥੀਆਂ ਨੂੰ ਹੱਥ 'ਤੇ ਸਿੱਖਿਆ ਦਿੰਨ ਦਿੱਤੀ ਜਾਂਦੀ ਹੈ ਜੋ ਉਹਨਾਂ ਨੂੰ ਅਸਲ ਦੁਨੀਆਂ ਦੇ ਕਮ ਕੰਮਕਾਜ ਨਾਲ ਜੋੜਦੀ ਹੈ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਜਿੱਦਾਂ ਕਿ ਆਪਾਂ ਇਸ ਵਿੱਚ ਹੋਰ ਵੀ ਤਰੀਕੇ ਜੋੜ ਸਕਦੇ ਹਾਂ ਜਿੱਦਾਂ ਕਿ ਨੈਟਵਰਕਿੰਗ ਅਤੇ ਸੰਬੰਧ ਬਣਾਉਣਾ ਇੱਕ ਕੁਛ ਹੋਰ ਵੀ ਜੋੜਨਾ ਹੋਏ ਤਾਂ ਆਪਾਂ ਜੋੜ ਸਕਦੇ ਹਾਂ ਜਿੱਦਾਂ ਨੈਤਿਕ ਅਤੇ ਸੋਸ਼ਲ ਜਿੰਮੇਵਾਰੀਆਂ ਧੰਨਵਾਦ ਜੀ